ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਮੋਡਰਨ ਮੋਡਰਨ ਫਰਨੀਚਰ ਤੋਂ ਬੋਲਦੇ ਹੋ ਜੀ ਹੋਰ ਮੈਮ ਤੁਹਾਡੇ ਤੋਂ ਅਸੀਂ ਉਹ ਲੈਣਾ ਸੀ ਸੋਫਾ ਸੈੱਟ ਬੈੱਡ ਅੱਛਾ ਜੀ ਵਧੀਆ ਨੇ ਜੀ ਅੱਛਾ ਜੀ ਛੋਟੇ ਬੱਚਿਆਂ ਲਈ ਅਲਮੀਰਾ ਵੀ ਮਿਲਦੀ ਹੈ ਅੱਛਾ ਜੀ ਅਤੇ ਹਾਂਜੀ ਸਾਡੇ ਵੀ ਇੱਕ ਹਾਂਜੀ ਸਾਡੇ ਵੀ ਗੁਆਂਢ 'ਚ ਲੈ ਕੇ ਗਏ ਸੀ ਅਸੀਂ ਉਨ੍ਹਾਂ ਤੋਂ ਤੁਹਾਡਾ ਨੰਬਰ ਲਿੱਤਾ ਸੀ ਜੋ ਉਨ੍ਹਾਂ ਦੇ ਬਹੁਤ ਵਧੀਆ ਫਰਨੀਚਰ ਆਇਆ ਸੀਗਾ ਇਸ ਕਰਕੇ ਅਸੀਂ ਅੱਛਾ ਜੀ ਅੱਛਾ ਜੀ ਵੈਸੇ ਤੁਹਾਡੀ ਦੁਕਾਨ ਕਿੱਥੇ ਹੈ ਜੇ ਹੈਗੀ ਸਾਨੂੰ ਕਿੱਦਾਂ ਪਤਾ ਲ ਅੱਛਾ ਜੀ ਕੇ ਸੀ ਰੋਡ ਅੱਛਾ ਜੀ ਅਸੀਂ ਕੱਲ੍ਹ ਨੂੰ ਆਵਾਂਗੇ ਜੇ ਸਾਨੂੰ ਦੁਕਾਨ ਦਾ ਨਾ ਪਤਾ ਲੱਗਿਆ ਅਸੀਂ ਕੌਲ ਵੀ ਕਰਾਂਗੇ ਅੱਛਾ ਛੋਟੇ ਬੱਚਿਆਂ ਲਈ ਟੇਬਲ ਟੀ ਵੀ ਅਲਮੀਰਾ ਮਿਲਦੀ ਟੀ ਵੀ ਅਲਮੀਰਾ ਜਾਣੀ ਹੈਗੀ ਹੈ ਸਾਨੂੰ ਪੂਰਾ ਫਰਨੀਚਰ ਚਾਹੀਦਾ ਗਾ ਕੀ ਰੇਟ ਲਗਾਉਂਗੇ ਸਾਨੂੰ ਅੱਛਾ ਜੀ ਠੀਕ ਹੈ ਜੀ ਹਾਂਜੀ ਫਿਰ ਕੱਲ੍ਹ ਠੀਕ ਹੈ ਜੀ ਅਸੀਂ ਕੱਲ੍ਹ ਨੂੰ ਫਿਰ ਆਵਾਂਗੇ ਕੇ ਸੀ ਰੋਡ 'ਤੇ ਹੈ ਨਾ ਜੀ ਦੁਕਾਨ ਤੁਹਾਡੀ ਅੱਛਾ ਜੀ ਠੀਕ ਹੈ ਜ਼ਰੂਰ ਹਾਂਜੀ ਸਾਡੇ ਵੀ ਲੈ ਕੇ ਗਏ ਸੀ ਸਾਨੂੰ ਵਧੀਆ ਲੱਗਿਆ ਤਾਂ ਹੀ ਫਿਰ ਉਨ੍ਹਾਂ ਤੋਂ ਤੁਹਾਡਾ ਨੰਬਰ ਲਿੱਤਾ ਅਤੇ ਅਸੀਂ ਕੌਲ ਕੀਤਾ ਜੀ ਚਲ ਵੈਸੇ ਵੀ ਲੈਣਾ ਸੀ ਫਰਨੀਚਰ ਮੈਂ ਕਿਹਾ ਚਲ ਠੀਕ ਹੈ ਜੀ ਠੀਕ ਹੈ ਜੀ ਕੱਲ੍ਹ ਨੂੰ ਅਵਾਂਗੇ ਹਾਂਜੀ ਓਕੇ ਹਾਂਜੀ ਵੈਲਕਮ ਜੀ